ਹੈਲੋ ਸਤਿ ਸ਼੍ਰੀ ਅਕਾਲ ਕੀ ਤੁਸੀਂ ਭੋਜਨਆਲੇ ਤੋਂ ਬੋਲ ਰਹੇ ਹੋ ਮੈਂ ਤੁਹਾਨੂੰ ਜਾਨਣਾ ਚਾਹੁੰਦੀ ਸੀ ਕਿ ਮੇਰੇ ਦੋਸਤ ਸੀ ਉਹ ਤੁਹਾਡੀ ਭੋਜਨਆਲੇ ਤੋਂ ਹੋ ਕੇ ਗਏ ਨੇ ਅਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਦੱਸਿਆ ਕਿ ਤੁਹਾਡੀ ਬਹੁਤ ਸਹੀ ਸਹੂਲਤਾਂ ਦਿੰਦ ਦਿੰਦੇ ਹੋ ਤੁਸੀਂ ਆਪਣੇ ਰੈਸਟੋਰੈਂਟ 'ਚ ਅਤੇ ਮੈਂ ਇਹ ਜਾਨਣਾ ਚਾਹੁੰਦੀ ਸੀ ਕਿ ਤੁਹਾਡੇ ਉੱਥੇ ਪਾਰਕਿੰਗ ਦੀ ਸੁਵਿਧਾ ਹੈਗੀ ਹੈ ਕਿਉਂਕਿ ਮੈਂ ਆਪਣੇ ਪਰਿਵਾਰ ਨਾਲ ਆਉਣਾ ਚਾਹੁੰਦੀ ਹਾਂ ਮੇਰੇ ਛੋਟੇ ਭਰਾ ਦਾ ਜਨਮ ਦਿਨ ਹੈ ਅਸੀਂ ਉਹਦਾ ਜਨਮ ਦਿਨ ਮਨਾਉਣਾ ਚਾਹੁੰਦੇ ਹਾਂ ਤੁਹਾਡੇ ਰੈਸਟੋਰੈਂਟ ਵਿੱਚ ਅਤੇ ਅਸੀਂ ਉਹਨੂੰ ਖਾਣੇ 'ਚ ਸਹੂਲਤ ਵੀ ਸਾਨੂੰ ਵਧੀਆ ਚਾਹੀਦੀ ਹੈ ਕਿਉਂਕਿ ਉਹਦੇ ਦੋਸਤਾਂ ਨੇ ਵੀ ਸਾਡੇ ਨਾਲ ਆਉਣਾ ਹੈ ਅਤੇ ਅਸੀਂ ਸਾਰੀ ਪੂਰੀ ਸਹੀ ਪਰਿਵਾਰ ਦੇ ਨਾਲ ਆਉਣਾ ਚਾਹੁੰਦੇ ਹਾਂ ਅਤੇ ਨਾਲ ਸਾਡੀ ਫਰੈਂਡਸ ਵੀ ਨਾਲੇ ਖਾਣ ਦੇ ਵਿੱਚ ਤੁਹਾਡੇ ਉੱਥੇ ਕੀ ਕੀ ਮੈਨਿਊ ਵਿੱਚ ਕਿੰਨੀ ਕੁ ਤੁਹਾਡੀ ਪਲੇਟਰ ਹੋਣਗੇ ਕੋਮਬੋ ਅਤੇ ਕਿੰਨੇ ਬੰਦੇ ਖਾ ਸਕਦੇ ਨੇ ਤੁਸੀਂ ਸਾਰੀ ਜਾਣਕਾਰੀ ਦੇ ਸਕਦੇ ਹੋ ਹੋਰ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦੀ ਸੀ ਕਿ ਉੱਥੇ ਟੇਬਲ 'ਤੇ ਕਿੰਨੇ ਜਣੇ ਬੈਠ ਸਕਦੇ ਇੱਕ 'ਤੇ ਤੁਸੀਂ ਸਾਡੇ ਅਰੇਂਜਮੈਂਟ ਕਰ ਸਕਦੇ ਹੋ ਅਸੀਂ ਬਰਥਡੇ ਮਨਾਉਣਾ ਹੈ ਅਤੇ ਸਾਨੂੰ ਅਸੀਂ ਕੇਕ ਵੀ ਕੱਟ ਕਰਨਾ ਚਾਹੁੰਦੇ ਹਾਂ ਅਤੇ ਅਗਰ ਕੇਕ ਦੀ ਸਹੂਲਤ ਤੁਹਾਨੂੰ ਸਾਨੂੰ ਉੱਥੇ ਮਿਲ ਜਾਵੇਗੀ ਸਾਨੂੰ ਬਹੁਤ ਵਧੀਆ ਰਹੇਗਾ ਹੋਰ ਵੀ ਸਾਨੂੰ ਤੁਹਾਡੇ ਉੱਥੇ ਜਾਨਣਾ ਚਾਹੁੰਦੇ ਕਿ ਸਮੇਂ ਉੱਥੇ ਕਿੰਨੇ ਵਜੇ ਤੱਕ ਤੁਹਾਡਾ ਬੰਦ ਹੁੰਦਾ ਹੈ ਸਾਨੂੰ ਪਤਾ ਲੱਗੇਗਾ ਸਾਨੂੰ ਜਿ ਜਿੱਦਾਂ ਸ ਦਾ ਟਾਈਮ ਹੋਵੇਗਾ ਕਿ ਅੱਠ ਤੋਂ ਨੌ ਵਜੇ ਤੱਕ ਅਸੀਂ ਪਾਰਟੀ ਕਰਨਾ ਚਾਹੁੰਦੇ ਹਾਂ ਤਾਂ ਉੰਨੇ ਵਜੇ ਤੱਕ ਕਿਆ ਤੁਹਾਡਾ ਖੁੱਲ੍ਹਾ ਰਹੇਗਾ ਰੈਸਟੋਰੈਂਟ